ਹੈਲੋ ਹਾਂਜੀ ਅੱਛਾ ਹਾਂਜੀ ਹਾਂਜੀ ਦੱਸੋ ਹਾਂਜੀ ਕੀ ਹੋ ਗਿਆ ਉਹਨੂੰ ਕਿਆ ਜ਼ਿਆਦਾ ਲੱਗ ਗਈ ਮੈਂ ਕਿਹਾ ਅੱਛਾ ਕੋਈ ਨਹੀਂ ਆ ਜਾਂਦੇ ਹਾਂ ਅਸੀਂ ਜਿੰਨਾ ਜਲਦੀ ਹੋ ਗਿਆ ਪਹੁੰਚ ਜਾਂਦੇ ਹਾਂ ਵੈਸੇ ਅਂਦਾ ਧਿਆਨ ਰੱਖਣਾ ਏ ਹਾਂਜੀ ਜ਼ਰੂਰ ਜੀ ਪਹੁੰਚ ਜਾਂਦੇ ਹਾਂ ਜੀ ਹਾਂ ਠੀਕ ਹੈ ਮੈਂ ਰਸਤੇ 'ਚ ਮਾਰਕੀਟ 'ਚੋਂ ਲੈ ਲੈਂਦੀ ਹਾਂ ਹਾਂਜੀ ਹਾਂਜੀ ਜ਼ਰੂਰ ਜੀ ਸਤਿ ਸ਼੍ਰੀ ਅਕਾਲ ਜੀ